ਚਿੱਤਰਕਾਰੀ ਦਾ ਬਹੁਤ ਜ਼ਿਆਦਾ ਸਾਨੂੰ ਪੰਜਾਬ ਦੇ ਅੰਦਰ ਇਹਦਾ ਪ੍ਰਸਥਾਨ ਕਰਦੇ ਹਾਂ ਅਸੀਂ ਜਿਹਦੇ ਨਾਲ ਬੱਚਿਆਂ ਨੂੰ ਵੀ ਅਸੀਂ ਗਾਈਡ ਕਰਦੇ ਹਾਂ ਜ਼ਰੂਰੀ ਨਹੀਂ ਹੈ ਕਿ ਪੂਰੇ ਦਿਨ ਦੇ ਅੰਦਰ ਅਸੀਂ ਪੂਰਾ ਚਿੱਤਰਕਾਰੀ ਕਰੀਏ ਜਦੋਂ ਤੁਹਾਨੂੰ ਟਾਈਮ ਮਿਲਦਾ ਅਤੇ ਅਸੀਂ ਉਸ ਚੀਜ਼ ਨੂੰ ਹੋਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਸਪੇਅਰ ਟਾਈਮ ਕਹਿ ਸਕਦੇ ਹਾਂ ਖਾਲੀ ਟਾਈਮ ਕਹਿ ਸਕਦੇ ਹਾਂ ਅਤੇ ਇਹ ਚੀਜ਼ ਸਾਨੂੰ ਇੱਕ ਕਿੱਥੇ ਨਾ ਕਿੱਥੇ ਮੋਟੀਵੇਟ ਕਰਦੀ ਆ ਕਿ ਇਹ ਸਾਨੂੰ ਜਿਹੜਾ ਫਰੀ ਟਾਈਮ ਦੇ ਅੰਦਰ ਜਿੱਥੇ ਸਾਨੂੰ ਬੋਰਿੰਗ ਜਾ ਫੀਲ ਕਰਦੇ ਹਾਂ ਉਹਦੇ ਅੰਦਰ ਅਸੀਂ ਆਪਣਾ ਇਸ ਚੀਜ਼ ਨੂੰ ਅਸੀਂ ਔਰ ਬੜਾਵਾ ਮਿਲਦਾ ਸਾਨੂੰ ਅਤੇ ਮੈਂ ਚਾਹਵਾਂਗਾ ਕਿ ਜੀ ਚਿੱਤਰਕਾਰੀ ਸਾਰਿਆਂ ਨੂੰ ਆਉਣੀ ਚਾਹੀਦੀ ਹੈ ਅਤੇ ਅੱਗੇ ਆਉਣ ਵਾਲੇ ਟਾਈਮ ਦੇ ਅੰਦਰ ਅਸੀਂ ਇਹਨੂੰ ਉਹ ਬਣਾਉਣ ਦੇ ਨਾਲ ਨਾਲ ਕੁਛ ਪ੍ਰੋਫੈਸ਼ਨਲ ਅਸੀਂ ਇਹਨੂੰ ਡਿਵੈਲਪ ਕਰ ਪਾਈਏ